ਭਾਰਤ ਦਾ ਖੇਤਰਫਲ ਬਹੁਤ ਹੀ ਜ਼ਿਆਦਾ ਵੱਡਾ ਹੈ ਭਾਰਤ ਵਿੱਚ ਅੱਡ ਅੱਡ ਤਰ੍ਹਾਂ ਦੇ ਮੌਸਮ ਪਾਏ ਜਾਂਦੇ ਹਨ ਠੰਢ ਗਰਮੀ ਅਤੇ ਬਰਸਾਤ ਦਾ ਮੌਸਮ ਅਤੇ ਹਾਲਾਂਕਿ ਇੱਥੇ ਬਰਫ ਤੱਕ ਵੀ ਪੈਂਦੀ ਹੈ ਤਾਂ ਉਵੇਂ ਅੱਡ ਅੱਡ ਜਗ੍ਹਾਵਾਂ ਨੇ ਜਿਵੇਂ ਕਿ ਜਿੱਥੇ ਬਰਫ ਪੈਂਦੀ ਹੈ ਤਾਂ ਉਹ ਇਲਾਕੇ ਹੈਗੇ ਜਿਵੇਂ ਜੰਮੂ ਐਂਡ ਕਸ਼ਮੀਰ ਅਤੇ ਹਿਮਾਚਲ ਇੱਥੇ ਬਰਫ ਬਹੁਤ ਜ਼ਿਆਦਾ ਪੈਂਦੀ ਅਤੇ ਜਦੋਂ ਇੱਥੇ ਬਰਫ ਪੈਂਦੀ ਹੈ ਤਾਂ ਦੂਜੇ ਇਲਾਕਿਆਂ ਦੇ ਲੋਕ ਇੱਥੇ ਘੁੰਮਣ ਆਉਂਦੇ ਨੇ ਤਾਂ ਜਦੋਂ ਬਰਫ ਪੈਂਦੀ ਹੈ ਤਾਂ ਉਥ ਉਸ ਟਾਈਮ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਆ ਘੁੰਮਣ ਲਈ ਬਰਫ ਦੇਖਣ ਲਈ ਅਤੇ ਜੇ ਆਪਾਂ ਗਰਮੀ ਦੀ ਗੱਲ ਕਰੀਏ ਗਰਮੀ ਤ ਤਾਂ ਬਹੁਤ ਜੇ ਗਰਮੀ ਹੈ ਤਾਂ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਉਹਦੇ ਏਰੀਆ ਹੈਗੇ ਜਿਵੇਂ ਕੇਰਲਾ ਤਾਮਿਲਨਾਡੂ ਹੋ ਗਿਆ ਪੰਜਾਬ ਹੋ ਗਿਆ ਠੀਕ ਅਤੇ ਆਪਾਂ ਜੇ ਹੁਣ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ 'ਚ ਕੀ ਹੈ ਕਿ ਰੇਤਲਾ ਏਰੀਆ ਅਤੇ ਇਹਦੇ 'ਚ ਕੀ ਹੁੰਦਾ ਕਿ ਦਿਨੇ ਜੇ ਗਰਮੀ ਹੈ ਤਾਂ ਗਰਮੀ ਵੀ ਹੱਦੋਂ ਵੱਧ ਹੁੰਦੀ ਹੇ ਅਤੇ ਜੇ ਰਾਤ ਹੈ ਤਾਂ ਰਾਤੀ ਜਿਹੜਾ ਰੇਤਾ ਉਹ ਠੰਡਾ ਹੋ ਜਾਂਦਾ ਤਾਂ ਉਹ ਠੰਡਾ ਹੋਣ ਕਾਰਨ ਕੀ ਹੈ ਕਿ ਰਾਤ ਨੂੰ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਤਾਂ ਇੱਥੇ ਕਹਿ ਸਕਦੇ ਹਾਂ ਕਿ ਆਪਾਂ ਦੋ ਤਰ੍ਹਾਂ ਦੇ ਮੌਸਮ ਇੱਕੋ ਵਾਰ 'ਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਹੈ ਦਿਨੇ ਗਰਮੀ ਅੰਤਾਂ ਦੀ ਅਤੇ ਰਾਤੀ ਅੰਤਾਂ ਦੀ ਠੰਡ ਅਤੇ ਜੇ ਹੁਣ ਆਪਾਂ ਬਰਸਾਤੀ ਮੌਸਮ ਦੀ ਗੱਲ ਕਰੀਏ ਤਾਂ ਬਰਸਾਤੀ ਮੌਸਮ ਸਭ ਤੋਂ ਜ਼ਿਆਦਾ ਜਿਹੜੇ ਸਮੁੰਦਰ ਦੇ ਕੰਢਿਆਂ ਦੇ ਨੇੜੇ ਇਲਾਕੇ ਆ ਉਹਨਾਂ 'ਚ ਹੁੰਦਾ ਜਿਵੇਂ ਕਿ ਗੋਆ ਹੋ ਗਿਆ ਹੈ ਨਾ ਅਤੇ ਮਹਾਰਾਸ਼ਟਰ 'ਚ ਵੀ ਬਹੁਤ ਜ਼ਿਆਦਾ ਬਰਸਾਤ ਪਾਈ ਜਾਂਦੀ ਆ ਅਤੇ ਬਰਸਾਤ ਵਾਲੇ ਮੌਸਮ 'ਚ ਹਿਊ ਹਿਊ ਹੁੰਮਸ ਜ਼ਿਆਦਾ ਹੁੰਦਾ ਅਤੇ ਚਿਪਚਿਪਾਹਟ ਵਾਲਾ ਮੌਸਮ ਜ਼ਿਆਦਾ ਰਹਿੰਦਾ ਹਾਲਾਂਕਿ ਕੇਰਲਾ ਵਿੱਚ ਵੀ ਬਰਸਾਤ ਜ਼ਿਆਦਾ ਪਾਈ ਜਾਂਦੀ ਹੈ ਅਤੇ ਜਿਹੜੇ ਟੂਰਿਸਟ ਹੈ ਉਹ ਸਮੁੰਦਰ ਦੇ ਕੰਢਿਆਂ ਵਾਲੇ ਕਿਨਾਰੇ ਜਦੋਂ ਬਰਸਾਤਾਂ ਹੁੰਦੀਆਂ ਨੇ ਤਦ ਅਲਰਟ ਜਾਰੀ ਕਰ ਦਿੱਤੇ ਜਾਂਦੇ ਆ ਅਤੇ ਉੱਥੇ ਘੱਟ ਜਾਂਦੇ ਨੇ ਫੇਰ ਇੱਦਾਂ ਹੀ ਇਹ ਜਿਹੜਾ ਟੂਰਿਸਟ ਦੇ ਥਰੂ ਇਹਨਾਂ ਇਲਾਕਿਆਂ ਦਾ ਅੱਡਾ ਅੱਡ ਮੌਸਮ ਦੇ ਅਧਾਰ ਦੇ ਉੱਤੇ ਰੁਜ ਰੋਟੀ ਪਾਣੀ ਚੱਲਦਾ